ਸਥਾਨਕ ਚੈਰਿਟੀ ਅਤੇ ਭਾਈਚਾਰਕ ਸੰਸਥਾਵਾਂ ਜਿਹੜੀਆਂ ਹਨ ਉਹ ਤਾਂ ਅੰਬਰਸਰ ਦੇ ਵਿੱਚ ਬਹੁਤ ਸਾਰੀਆਂ ਹਨ ਭ ਸਥਾਨਕ ਭਾਈਚਾਰਾ ਸੰਸਥਾਵਾਂ ਜਿਹੜੀਆਂ ਆ ਨੇ ਚੈਰੀਟੇਬਲ ਜਿਹੜੇ ਹੈਗੇ ਨੇ ਹੋਸਪਿਟਲ ਹੋ ਗਏ ਹਨ ਅਤੇ ਜਿਹਦੇ ਵਿੱਚ ਕਿ ਫਰੀ ਇਲਾਜ ਵੀ ਕੀਤੇ ਜਾਂਦੇ ਹਨ ਗਰੀਬਾਂ ਦੇ ਉਹਦੇ ਨਾਲ ਇਹ ਹੁੰਦਾ ਕਿ ਗਰੀਬ ਤੋਂ ਗਰੀਬ ਬੰਦਾ ਵੀ ਆਪਣੀ ਜਿਹੜੀ ਹੈਗੀ ਹੈ ਆਪਣਾ ਇਲਾਜ ਕਰਵਾ ਸਕਦਾ ਹੈ ਉਹਦੇ ਨਾਲ ਇਹ ਵਾ ਕਿ ਉਹਨੂੰ ਕਿਸੇ ਕੋਈ ਵੀ ਤਰ੍ਹਾਂ ਦਾ ਜਿਵੇਂ ਬੁਖਾਰ ਆ ਜਾਂ ਕੋਈ ਖਾਂਸੀ ਆ ਜਾਂ ਕੋਈ ਵੀ ਹੈ ਸਰਦੀ ਲੱਗ ਗਈ ਆ ਜਾਂ ਕੁਛ ਵੀ ਆ ਉਹ ਆਪਣਾ ਇਲਾਜ ਕਰਵਾ ਸਕਦਾ ਅਤੇ ਬੜਾ ਫਰੀ ਦੇ ਵਿੱਚ ਇਲਾਜ ਇੱਕ ਹਿਸਾਬ ਨਾਲ ਹੋ ਜਾਂਦਾ ਪ੍ਰਭਾਵ ਵੀ ਇਹ ਪੈਂਦਾ ਕਿ ਚਲੋ ਕੁਛ ਉਹਨਾਂ ਦਾ ਗਰੀਬਾਂ ਦਾ ਵੀ ਕੁਛ ਬਣ ਜਾਂਦਾ ਬ ਗਰੀਬ ਬੰਦਾ ਦਵਾਈ ਲੈਣ ਤੋਂ ਤਾਂ ਨਹੀਂ ਨਾ ਬੈਠਾ ਰਹਿੰਦਾ ਨੇੜੇ ਦੇਖੋ ਬੁਢਾਪਾ ਘਰ ਤਾਂ ਬਹੁਤ ਸਾਰੇ ਹਨ ਬਾਲ ਸੰਭਾਲ ਵੀ ਹਨ ਪਾਲਣ ਪੋਸ਼ਣ ਜਿੱਥੇ ਕਿ ਬਹੁਤ ਵਧੀਆ ਹੋ ਰਿਹਾ ਬੁਢਾਪਾ ਲੋਕ ਬਹੁਤ ਸਾਰਿਆਂ ਦਾ ਇਹ ਜਗ੍ਹਾ 'ਤੇ ਦਾਨ ਵੀ ਦਿੰਦੇ ਹਨ ਬੁਢਾਪਾ ਜਿਹੜੀ ਸੱਭਿ ਬੁਢਾਪਾ ਕ ਹੈਗਾ ਵਾ ਬੁਢਾਪਾ ਘਰ ਉੱਥੇ ਕਈ ਲੋਕ ਦਾਨ ਵੀ ਬਹੁਤ ਸਾਰਾ ਦੇ ਕੇ ਆਉਂਦੇ ਹਨ ਜਿਹਦੇ ਨਾਲ ਕਿ ਬਜ਼ੁਰਗ ਬਜ਼ੁਰਗਾਂ ਦਾ ਪਾਲਣ ਪੋਸ਼ਣ ਬੜੇ ਅੱਛੇ ਤਰ੍ਹਾਂ ਹੋ ਜਾਂਦਾ ਬੇਘਰ ਜਿਹੜੇ ਪਰਿਵਾਰ ਹੈਗੇ ਨੇ ਉਹਨਾਂ ਦੀ ਵੱਧਦੀ ਗਿਣਤੀ ਵੀ ਬਹੁਤ ਸਾਰੀ ਵੇਖੀ ਹੈ ਮੈਂ ਬੇਘਰ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਲੋਕ ਕਈ ਕੀ ਕਰਦੇ ਹਨ ਕਿ ਜਿਵੇਂ ਕਿ ਟਿਫਨ ਦੀ ਸ ਸਰਵਿਸ ਦੇ ਦਿੰਦੇ ਹਨ ਉਹਨਾਂ ਨੂੰ ਫਰੀ ਦਵਾਈ ਦੇ ਦਿੰਦੇ ਹਨ ਫਰੀ ਉਹਨਾਂ ਦਾ ਇਲਾਜ ਕਰਵਾ ਦਿੰਦੇ ਹਨ ਇਹਦੇ ਨਾਲ ਇਹ ਹੁੰਦਾ ਦੂਜੇ ਬੰਦਾ ਵੀ ਕੋਈ ਪ੍ਰਭਾਵਿਤ ਨਹੀਂ ਹੁੰਦਾ ਅਤੇ ਉਹਨਾਂ ਦਾ ਫ੍ਰੀ ਇਲਾਜ ਵੀ ਹੋ ਜਾਂਦਾ